ਪੰਜਾਬ ਵਿੱਚ ਸਿਹਤ ਸਹੂਲਤਾਵਾਂ ਬਹੁਤ ਸਾਰੀਆਂ ਲਾਗੂ ਕੀਤੀਆਂ ਗਈਆਂ ਹਨ ਜਿਵੇਂ ਕਿ ਹੋਸਪਿਟਲ ਹੋਸਪਿਟਲ ਜੇ ਤਾਂ ਉਹ ਸ਼ਹਿਰ ਦੇ ਬਾਹਰ ਹੋਵੇ ਤਾਂ ਸਾਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਅਤੇ ਜੇ ਉਹ ਸ਼ਹਿਰ ਦੇ ਅੰਦਰ ਹੋਵੇ ਤਾਂ ਸਾਨੂੰ ਟਰੈਫਿਕ ਰਾਹੀਂ ਬਹੁਤ ਹੀ ਦਿੱਕਤ ਆਉਂਦੀ ਹੈ ਜੇ ਜੇ ਹੋਸਪਿਟਲ ਵਿੱਚ ਅਸੀਂ ਪਹੁੰਚਦੇ ਹਾਂ ਤਾਂ ਕਈ ਵਾਰ ਉੱਥੇ ਡਾਕਟਰ ਨਹੀਂ ਹੁੰਦੇ ਅਤੇ ਜੇ ਡਾਕਟਰ ਹੁੰਦੇ ਹਨ ਤਾਂ ਉੱਥੇ ਕਈ ਵਾਰ ਸਾਨੂੰ ਦਵਾਈ ਨਹੀਂ ਮਿਲ ਕੋਈ ਵੀ ਦਵਾਈ ਨਹੀਂ ਮਿਲ ਸਕਦੀ ਇਸ ਲਈ ਸਾਨੂੰ ਬਹੁਤ ਹੀ ਦਿੱਕਤ ਆਉਂਦੀ ਹੈ ਅਤੇ ਪੰਜਾਬ ਵਿੱਚ ਮੌਜੂਦਾ ਸਰਕਾਰ ਦੁਆਰਾ ਖੋਲ੍ਹੇ ਗਏ ਕਲੀਨ ਮੁਹੱਲਾ ਕਲੀਨਿਕ ਦੁਆਰਾ ਸਾਨੂੰ ਕੋਈ ਵੀ ਛੋਟੀ ਮੋਟੀ ਬਿਮਾਰ ਬਿਮਾਰੀ ਖੰਘ ਜ਼ੁਕਾਮ ਜਾਂ ਬੁਖਾਰ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹਨ ਅਤੇ ਅ ਅਸੀਂ ਉਹਨਾਂ ਦੀ ਮੈਡੀਸਨ ਲਈ ਅਸੀਂ ਮੁਹੱਲਾ ਕਲੀਨਿਕ ਦੀ ਵਰਤੋਂ ਕਰ ਸਕਦੇ ਹਾਂ ਅਤੇ ਪੰਜਾਬ ਵਿੱਚ ਜਿਵੇਂ ਕਿ ਅਸੀਂ ਕਈ ਵਾਰ ਐਡਮਿਟ ਹੋਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਪੰਜਾਬ ਵਿੱਚ ਏਮਜ ਹਸਪਤਾਲ ਵਗੈਰਾ ਖੁੱਲ੍ਹ ਹਨ ਅਤੇ ਉਹ ਸਾਡੀ ਮਦਦ ਕਰਦੇ ਹਨ ਪੰਜਾਬ ਵਿੱਚ ਹੋਰ ਵੀ ਜਿਵੇਂ ਕਿ ਡਿਸਪੈਂਸਰੀ ਵਗੈਰਾ ਜਿੱਥੇ ਕਿ ਸਾਡੀ ਸਾਡੀ ਮਦਦ ਕੀਤੀ ਜਾਂਦੀ ਹੈ ਜੇ ਅਸੀਂ ਉੱਥੋਂ ਵੀ ਛੋਟੀ ਮੋਟੀ ਕੋਈ ਵੀ ਦਵਾਈ ਉੱਥੋਂ ਲੈ ਸਕਦੇ ਹਨ ਅਤੇ ਫਿਰ ਵੀ ਲੈ ਸਕਦੇ ਹਾਂ ਅਤੇ